ਨੌ ਅਕਤੂਬਰ ਦੋ ਜੀਰੋ ਜੀਰੋ ਦੋ ਸੱਤ ਦਸੰਬਰ ਦੋ ਜੀਰੋ ਜੀਰੋ ਅੱਠ ਇੱਕ ਸੱਤ ਮਈ ਦੋ ਜੀਰੋ ਜੀਰੋ ਚਾਰ ਚਾਰ ਜਨਵਰੀ ਦੋ ਜੀਰੋ ਜੀਰੋ ਸੱਤ ਇੱਕ ਜੀਰੋ ਜੂਨ ਦੋ ਜੀਰੋ ਜੀਰੋ ਇੱਕ